ਜਿਵੇਂ ਕਿ ਇਹਦੇ ਵਿੱਚ ਯੋਗਾ ਬਾਰੇ ਪੁੱਛਿਆ ਗਿਆ ਯੋਗਾ ਸਾਡੀ ਸੁ ਤੰਦਰੁਸਤਰੀ ਤੰਦਰੁਸਤੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਹੁਤ ਵਧੀਆ ਯੋਗਦਾਨ ਪਾਉਣ ਦਾ ਸਾਡੇ ਜੀਵਨ 'ਤੇ ਕਿਉਂਕਿ ਜਿਵੇਂ ਮੈਂ ਵੀ ਹੁਣ ਵੰਨ ਏ ਇੱਕ ਸਾਲ ਹੋਇਆ ਵੀ ਜਦੋਂ ਤੋਂ ਯੋਗਾ ਵਗੈਰਾ ਐਕਸਾਈਜ਼ ਵਗੈਰਾ ਸਟਾਰਟ ਕੀਤੀ ਹੈ ਤਾਂ ਉਤੋਂ ਪਹਿਲਾਂ ਤਾਂ ਕਦੇ ਵੀ ਨਹੀਂ ਸੁੱਤੇ ਰਹਿਣਾ ਕੋਈ ਟਾਈਮਿੰਗ ਨਹੀਂ ਉੱਠਣ ਦੀ ਤਾਂ ਇਹਦੇ ਬਾਰੇ ਕੁਝ ਨੌਲੇਜ ਹੀ ਨਹੀਂ ਸੀ ਜੇ ਕੋਈ ਕਰਦਾ ਵੀ ਸੀ ਨਾ ਜਦੋਂ ਜਾਂ ਕੋਈ ਕਹਿੰਦਾ ਵੀ ਸੀ ਵੀ ਤੁਸੀਂ ਵੀ ਕਰਿਆ ਕਰੋ ਤਾਂ ਉਦੋਂ ਹੱਸਦੇ ਹੁੰਦੇ ਸੀ ਵੀ ਕਹਿ ਦਈਦਾ ਸੀ ਇਹ ਬੜੀ ਚੀਜ਼ ਹੈ ਵੀ ਅਸੀਂ ਤਾਂ ਸੁੱਤੇ ਉੱਠਦੇ ਹੀ ਨੀਗੇ ਅਤੇ ਪਰ ਜਦੋਂ ਤੋਂ ਹੁਣ ਯੋਗਾ ਦੀ ਸ਼ੁਰੂਆਤ ਕੀਤੀ ਹੈ ਅਤੇ ਹੁਣ ਉਦੋਂ ਤੋਂ ਲੈ ਕੇ ਸਰੀਰ ਵਿੱਚ ਕਾਫ਼ੀ ਸਾਰੀਆਂ ਤਬਦੀਲੀਆਂ ਆਈਆਂ ਜਿਵੇਂ ਇੱਕ ਤਾਂ ਸਵੇਰੇ ਜਲਦੀ ਉੱਠਣਾ ਵਰਕਆਊਟ ਕਰਨਾ ਯੋਗਾ ਵਗੈਰਾ ਕਰਨਾ ਫਰੈਸ਼ ਮਾਇੰਡ ਨਾਲ ਆਪਣਾ ਤਾਂ ਉਹਦੇ ਕਰਕੇ ਸਾਰਾ ਦਿਨ ਐਕਟਿਵ ਰਹੀਦਾ ਕੋਈ ਥਕਾਵਟ ਨਹੀਂ ਜਿਵੇਂ ਪਹਿਲਾਂ ਤਾਂ ਸਰੀਰ ਦੇ ਕੀ ਇੱਕ ਇੱਕ ਜੋੜ ਜਾਮ ਵਗੈਰਾ ਹੋਏ ਸੀ ਮੰਨ ਕੇ ਚੱਲੋ ਇਸ ਤਰ੍ਹਾਂ ਹੀ ਹੁੰਦਾ ਜਾਮ ਹੋਏ ਸੀ ਹੁਣ ਜਦੋਂ ਤੋਂ ਯੋਗਾ ਵਗੈਰਾ ਕਰਨ ਲੱਗੇ ਜਾਂ ਐਕਸਰਸਾਈਜ਼ ਤਾਂ ਸਾਰੇ ਜੋਇੰਟ ਜਿਵੇਂ ਖੁੱਲ੍ਹ ਗਏ ਹੈ ਪੂਰਾ ਫਲੈਕਸੀਬਲ ਰਹੀਦਾ ਸਰੀਰ ਵੀ ਕੋਈ ਵੀ ਬਾਡੀ 'ਚ ਪੇਨ ਵਗੈਰਾ ਨਹੀਂ ਹੈ ਅਤੇ ਨਹੀਂ ਤਾਂ ਪਹਿਲਾਂ ਕੀ ਸੀ ਸਾਰਾ ਦਿਨ ਥੱਕੇ ਥੱਕੇ ਰਹਿਣਾ ਸੁਸਤੀ ਉੱਠਣਾ ਹੀ ਨਾ ਕੋਈ ਵੀ ਕੋਈ ਜ਼ਿੰਦਗੀ 'ਚ ਉਹ ਹੀ ਨਹੀਂ ਸੀਗਾ ਹੁਣ ਜਦੋਂ ਤੋਂ ਇਹ ਜੁਆਇਨ ਕੀਤਾ ਤਾਂ ਉਦੋਂ ਤੋਂ ਪੂਰਾ ਖੁਸ਼ ਵੀ ਰਹੀਦਾ ਸਾਰਾ ਕੁਛ ਕੋਈ ਤਕਲੀਫ਼ ਨਹੀਂ ਹੈ ਸ ਪੂਰਾ ਦਿਨ ਫਰੈਸ਼ ਰਹੀਦਾ ਸਵੇਰ ਤੋਂ ਉੱਠੋ ਸ਼ਾਮ ਤੱਕ ਜਿਵੇਂ ਮਰਜ਼ੀ ਆਪਣਾ ਭੱਜੇ ਫਿਰੋ ਪਹਿਲਾਂ ਕੀ ਸੀ ਸਾਰਾ ਦਿਨ ਸੁਸਤੀ ਵਗੈਰਾ ਇਸ ਕਰਕੇ ਸ ਯੋਗਾ ਵਗੈਰਾ ਦਾ ਜਾਂ ਐਕਸਰਸਾਈਜ਼ ਵਗੈਰਾ ਦਾ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਅਹਿਮੀਅਤ ਹੈ ਪਰ ਨਾ ਲੋਕ ਵੈਸੇ ਇਸ ਗੱਲ ਨੂੰ ਸਮਝਦੇ ਨਹੀਂ ਹੈ ਵੀ ਕਹਿ ਦਿੰਦੇ ਇਹ ਚੀਜ਼ ਨਹੀਂ ਹੈ ਪਰ ਜਿਹੜਾ ਕੋਈ ਜਿਹੜਾ ਕੋਈ ਇਸ ਚੀਜ਼ ਨੂੰ ਮੰਨਦਾ ਹੈ ਜਾਂ ਜਿਹੜਾ ਕੋਈ ਜਿਹਨੇ ਇਹ ਚੀਜ਼ ਨੂੰ ਸਟਾਰਟ ਕਰ ਲਿਆ ਨਾ ਉਹਨੂੰ ਇਸ ਚੀਜ਼ ਦੀ ਅਹਿਮੀਅਤ ਬਾਰੇ ਪਤਾ ਲੱਗਿਆ ਜਿਵੇਂ ਹੁਣ ਇੱਕ ਸਾਲ ਤੋਂ ਮੈਂ ਹੀ ਇਹ ਸਟਾਰਟ ਕੀਤਾ ਅਤੇ ਮੈਨੂੰ ਵੀ ਪਤਾ ਲੱਗਿਆ ਨਹੀਂ ਤਾਂ ਇੰਨੀ ਏਜ ਹੋਣ ਦੇ ਬਾਵਜੂਦ ਕਦੇ ਯੋਗਾ ਜਾਂ ਐਕਸਰਸਾਈਜ਼ ਵਗੈਰਾ ਬਾਰੇ ਕਦੇ ਡਾਈਟ ਬਾਰੇ ਜਾਂ ਕੁਛ ਵੀ ਹੈਲਥ ਬਾਰੇ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਤਾਂ ਐਕਸਰਸਾਈਜ਼ ਯੋਗਾ ਇਹ ਸਾਰਾ ਹੈਲਥ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਆਪਣੇ ਮਾਇੰਡ ਨੂੰ ਵੀ ਫਰੈਸ਼ ਰੱਖਦਾ ਸਾਰੇ ਪਾਸੇ ਫਰੈਸ਼ ਰੱਖਦਾ ਬਾਡੀ ਸ਼ੇਪ ਬਾਡੀ ਵੀ ਸ਼ੇਪ 'ਚ ਇਸੇ ਕਾਰਨ ਹੀ ਆਉਂਦੀ ਹੈ ਨਹੀਂ ਤਾਂ ਆਪਣਾ ਕੀ ਹੈ ਸਰੀਰ ਇੱਕੋ ਜਿਹਾ ਹੀ ਹੁੰਦਾ ਜਦੋਂ ਆਪਾਂ ਐਕਸਰਸਾਈਜ਼ ਵਗੈਰਾ ਜਾਂ ਯੋਗਾ ਵਗੈਰਾ ਸਟਾਰਟ ਕਰਦੇ ਹਾਂ ਨਾ ਤਾਂ ਆਪਣੀ ਬਾਡੀ ਵੀ ਸ਼ੇਪ 'ਚ ਆਉਂਦੀ ਹੈ ਆਪਾਂ ਸੁੰਦਰ ਵੀ ਦਿਖਣ ਲੱਗ ਪੈਂਦੇ ਹਾਂ ਸਰੀਰ ਦੀ ਤਕਲੀਫ਼ ਹੈ ਜਿਹੜੀ ਬੋਡੀ ਪੇਨ ਵਗੈਰਾ ਆਪਣੇ ਜੋੜਾਂ ਜਾੜਾਂ 'ਚ ਦਰਦ ਦੁਰਦ ਸਟਾਰਟ ਹੋ ਰਿਹਾ ਹੁੰਦਾ ਉਮਰ ਦੇ ਵਧਣ ਨਾਲ ਉਹ ਵੀ ਸਾਰਾ ਕੁਝ ਹੱਟਦਾ ਹੈ ਸੋ ਜੜ ਵਧੀਆ ਫੀਲ ਹੁੰਦਾ ਆਪਣੇ ਆਪ ਨੂੰ ਚਿਹਰੇ 'ਤੇ ਵੀ ਰੰਗਤ ਆਉਂਦੀ ਹੈ ਅਲੱਗ ਹੀ ਲੁੱਕ ਦਿਖਦੀ ਹੈ ਸੋ ਇਸ ਕਰਕੇ ਯੋਗਾ ਯੁਗਾ ਦਾ ਤਾਂ ਆਪਣਾ ਸਰੀਰ 'ਚ ਬਹੁਤ ਵਧੀਆ ਯੋਗਦਾਨ ਹੈ ਔਰ ਮੈਂ ਹੀ ਖੁਦ ਆਪਣੇ ਆਪਣੇ 'ਤੇ ਹੀ ਇਹ ਵੀ ਫੀਲ ਕੀਤਾ ਵੀ ਮੈਂ ਯੋਗਾ ਵਗੈਰਾ ਸਟਾਰਟ ਕਰਨ ਤੋਂ ਬਾਅਦ ਮੈਨੂੰ ਕੀ ਫੀਲਿੰਗ ਆਈ ਹੈ ਸੋ ਥੈਂਕ ਯੂ